ਘਰ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਸਾਫ ਰੱਖਣ ਲਈ ਸਭ ਤੋਂ ਪਹਿਲਾਂ ਪਾਲਤੂ ਜੰਗਲੀ ਘਾਹ ਨੂੰ ਕਟਵਾਉਂਦੇ ਹਾਂ ਫਿਰ ਬਜ਼ਾਰ ਤੋਂ ਸਪਰੇਅ ਲੈ ਕੇ ਸਪਰੇਅ ਕਰਦੇ ਹਾਂ ਤਾਂ ਕਿ ਘਾਹ ਜਿਹੜਾ ਹੈ ਉਹ ਸੜ੍ਹ ਜਾਵੇ ਪੁਸ਼ ਪਸ਼ੂ ਜੰਗਲੀ ਘੁੰਮਦੇ ਹਨ ਉਹਨਾਂ ਨੂੰ ਫੜ੍ਹ ਕੇ ਗਊਸ਼ਾਲਾ ਵਿੱਚ ਜਮ੍ਹਾਂ ਕਰਵਾਉਂਦੇ ਹਾਂ ਜਿਹੜਾ ਘਰ ਦਾ ਕੂੜਾ ਕਰਕਟ ਹੁੰਦਾ ਹੈ ਉਹਨੂੰ ਨਗਰ ਪਾਲਿਕਾ ਵੱਲੋਂ ਇੱਕ ਬਹੁਤ ਬੜਾ ਜਗ੍ਹਾ ਬਣਾਈ ਹੈ ਉ ਉਹਦੇ ਵਿੱਚ ਸਿੱਟਦੇ ਹਾਂ ਅਤੇ ਉਹਨੂੰ ਰੋਜ਼ ਉਸ ਜਗ੍ਹਾ ਸਾਫ ਹੁੰਦੀ ਹੈ ਜਿਸ ਨਾਲ ਕਿ ਬਿਮਾਰੀਆਂ ਨਾ ਫੈਲਣ ਮੱਛਰ ਤੋਂ ਬਚਣ ਲਈ ਦਵਾਈ ਸਪਰੇਅ ਕਰਦੇ ਹਾਂ ਡੀਜ਼ਲ ਦਾ ਸਪਰੇਅ ਕਰਦੇ ਹਾਂ ਤਾਂ ਕਿ ਮੱਛਰ ਨਾ ਵੱਧ ਜਾਣ